ਸਤਿ ਸ਼੍ਰੀ ਅਕਾਲ ਜੀ ਵੀਰੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜ਼ਿਆਦਾਤਰ ਲੋਕਾਂ ਨੂੰ ਹੱਥ ਨਾਲ ਪੇਂਟਿੰਗ ਬਣਾ ਕੇ ਹੀ ਤੋਹਫ਼ੇ ਵਜੋਂ ਦਿੰਦਾ ਕਿਉਂਕਿ ਹੱਥ ਨਾਲ ਬਣੀ ਪੇਂਟਿੰਗ ਅਤੇ ਵੈਸੇ ਜਿਹੜੀ ਪੇਂਟਿੰਗ ਹੁੰਦੀ ਹੈ ਜਾਂ ਹੱਥ ਨਾਲ ਬਣੇ ਕਾਰਡ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜਿਹੜੀ ਵੈਸੇ ਪੇਂਟਿੰਗ ਹੁੰਦੀ ਹੈ ਉਹਦੇ ਨਾਲ ਤੁਹਾਡੇ ਕੋਈ ਅਨੁਭਵ ਨਹੀਂ ਹੁੰਦੇ ਹੈਗੇ ਵਿਚਾਰ ਨਹੀਂ ਰਲੇ ਹੁੰਦੇ ਪਰ ਜਦੋਂ ਤੁਸੀਂ ਹੱਥ ਨਾਲ ਕਾਰਡ ਕਿਸੇ ਨੂੰ ਵੀ ਤੋਹਫ਼ੇ ਵਜੋਂ ਦਿੰਦੇ ਹੋ ਉਹਦੇ ਨਾਮ ਵਿੱਚ ਤੁਹਾਡੀਆਂ ਯਾਦਾਂ ਤੁਹਾਡਾ ਪਿਆਰ ਤੁਹਾਡੇ ਅਹਿਸਾਸ ਪਰੋਏ ਹੁੰਦੇ ਹਨ ਜੋ ਕਿ ਬਹੁਤ ਹੀ ਵਧੀਆ ਅਨੁਭਵ ਹੁੰਦਾ ਅਤੇ ਉਹਨਾਂ ਦਾ ਮੁੱਲ ਵੀ ਜ਼ਿਆਦਾ ਹੁੰਦਾ ਜਦੋਂ ਕਿਤੇ ਵੀ ਤੁਸੀਂ ਹੱਥ ਨਾਲ ਬਣੇ ਕਾਰਡ ਦਾ ਕਿਸੇ ਨੂੰ ਤੋਹਫ਼ਾ ਦਿੰਦੇ ਹੋ ਜਾਂ ਤੁਸੀਂ ਦੁਬਾਰਾ ਉਸਨੂੰ ਦੇਖਦੇ ਹੋ ਤਾਂ ਤੁਹਾਨੂੰ ਪੁਰਾਣੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਇਸ ਲਈ ਹੀ ਕੋਸ਼ਿਸ਼ ਕਰੋ ਕਿ ਜਿਹੜਾ ਹੱਥ ਨਾਲ ਬਣਿਆ ਕਾਰਡ ਉਹਨੂੰ ਤਰਜੀਹ ਦਿਓ ਕਿਉਂ ਉਹਦੇ ਵਿੱਚ ਤੁਹਾਡੇ ਅਹਿਸਾਸ ਵਿਚਾਰ ਪਿਆਰ ਭਾਵਨਾਵਾਂ ਇਨਵੋਲਵ ਹੁੰਦੀਆਂ ਨੇ ਜੋ ਕਿ ਤੁਹਾਨੂੰ ਜਾਂ ਤੁਸੀਂ ਜਿਸ ਨੂੰ ਵੀ ਤੋਹਫ਼ਾ ਦਿੰਦੇ ਹੋ ਉਸ ਨੂੰ ਬਹੁਤ ਹੀ ਪਿਆਰ ਦਾ ਅਨੁਭਵ ਮਹਿਸੂਸ ਕਰਵਾਉਂਦੀਆਂ ਨੇ ਇਹਦੇ ਨਾਲ ਤੁਹਾਡਾ ਦਿਲੀਂ ਪਿਆਰ ਵਿੱਚ ਵਾਧਾ ਹੁੰਦਾ ਅਤੇ ਇੱਕ ਦੂਜੇ ਦੇ ਨੇੜੇ ਹੋਣ ਦਾ ਹੋਰ ਵੀ ਮੌਕਾ ਵਧੀਆ ਮਿਲ ਜਾਂਦਾ ਬਾਕੀ ਮੈਂ ਤਾਂ ਇਹ ਹੀ ਸਲਾਹ ਦੇਵਾਂਗਾ ਕਿ ਜੇ ਜੇ ਹੱਥ ਨਾਲ ਬਣੇ ਕਾਰਡ ਨੇ ਕੋਸ਼ਿਸ਼ ਕਰੋ ਕਿ ਉਹ ਦਿਓ ਪੇਂਟਿੰਗ ਅਤੇ ਹੱਥ ਨਾਲ ਦਿੱਤੇ ਹੋਏ ਕਾਰਡ ਦਾ ਬਹੁਤ ਜ਼ਿਆਦਾ ਫ਼ਰਕ ਹੁੰਦਾ ਧੰਨਵਾਦ